ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਜੋਸ਼ੀ ਕੰਪਿਊਟਰ ਸ਼ੋਪ ਤੋਂ ਬੋਲਦੇ ਭਾਅ ਜੀ ਮੈਂ ਨਾ ਤੁਹਾਡੇ ਕੋਲ ਇੱਕ ਲੀਨੋਵੋ ਕੰਪਨੀ ਦਾ ਲੈਪਟੋਪ ਮੰਗਵਾਇਆ ਸੀਗਾ ਅਤੇ ਭਾਅ ਜੀ ਤੁਸੀਂ ਕਹਿੰਦੇ ਸੀ ਚਾਰ ਦਿਨ ਦੇ ਵਿੱਚ ਵਿੱਚ ਮਿਲ ਜੂਗਾ ਭਾਅ ਜੀ ਪੰਜ ਦਿਨਾਂ ਬਾਅਦ ਮੈਨੂੰ ਮਿਲਿਆ ਉਹ ਲੈਪਟੋਪ ਅਤੇ ਜਿਹੜਾ ਲੈਪਟੋਪ ਦੇਣ ਆਇਆ ਸੀ ਭਾਅ ਜੀ ਉਹਦਾ ਬੀਹੇਵ ਇੰਨਾਂ ਘਟੀਆ ਸੀਗਾ ਨਾ ਬਹੁਤ ਜ਼ਿਆਦੇ ਅਤੇ ਜਦੋਂ ਮੈਂ ਲੈਪਟੋਪ ਖੋਲ੍ਹ ਕੇ ਦੇਖਿਆ ਮੈਨੂੰ ਐਵੇਂ ਲੱਗੇ ਜਿਵੇਂ ਕਿ ਉਹ ਸੈਕਿੰਡ ਹੈਂਡ ਆ ਨਾ ਹੀ ਭਾਅ ਜੀ ਉਹਦੀ ਪੈਕਿੰਗ ਵਧੀਆ ਕੀਤੀ ਹੋਈ ਸੀਗੀ ਅਤੇ ਨਾਲ ਹੀ ਜਦੋਂ ਮੈਂ ਚਲਾਇਆ ਅਤੇ ਨਾ ਹੀ ਉਹਦਾ ਪ੍ਰੋਫੈਸਰ ਇੰਨਾਂ ਤੇਜ਼ ਸੀਗਾ ਬਹੁਤ ਸਲੋਅ ਚੱਲ ਰਿਹਾ ਸੀਗਾ ਬਟਨ ਉਹਦੇ ਸ ਤਾਂ ਭਾਅ ਜੀ ਸਾਰੇ ਜਾਣੀ ਕਿ ਪ੍ਰੋਪਰ ਕੋਈ ਨਹੀਂ ਸੀ ਵਰਕ ਕਰਦਾ ਪਿਆ ਮੈਂ ਉੱਪਰ ਸਕਰੈਚ ਪਏ ਹੋਏ ਸਕਰੀਨ 'ਤੇ ਅਤੇ ਭਾਅ ਜੀ ਦੋ ਦੋ ਤਿੰਨ ਤਿੰਨ ਘੰਟੇ ਲੱਗ ਜਾਂਦੇ ਇਹਨੂੰ ਚਾਰਜ ਕਰਨ ਨੂੰ ਅਤੇ ਦਸਾਂ ਮਿੰਟਾਂ ਬਾਅਦ ਇਹਦੀ ਬੈਟਰੀ ਲੋਅ ਹੋ ਜਾਂਦੀ ਹੈ ਅਤੇ ਨਾਲ ਹੀ ਭਾਅ ਜੀ ਇਹ ਜੇ ਮੈਂ ਤੁਹਾਡੀ ਦੁਕਾਨ 'ਤੇ ਆਇਆ ਤਾਂ ਮੈਂ ਇਹ ਵਾਪਸ ਕਰਕੇ ਜਾਊਂਗਾ ਅਤੇ ਮੈਂ ਆਪਣੇ ਪੈਸੇ ਵਾਪਸ ਲੈ ਕੇ ਜਾਊਂਗਾ ਕਿਉਂਕਿ ਮੈਂ ਜਮਾਂ ਹੀ ਇਸ ਚੀਜ਼ ਤੋਂ ਸੈਟਿਸਫਾਈ ਨਹੀਂ ਹੈਗਾ ਜੀ ਥੈਂਕ ਯੂ ਭਾਅ ਜੀ ਧੰਨਵਾਦ